ਸਾਡਾ ਰਾਜ ਪੰਜਾਬ ਰਾਜ ਹੈ ਇਸ ਵਿੱਚ ਸਿੱਖਿਆ ਪ੍ਰਣਾਲੀ ਵਿੱਚ ਪੰਜਾਬੀ ਭਾਸ਼ਾ ਇੱਕ ਅਹਿਮ ਭੂਮਿਕਾ ਨਿਭਾਉਂਦੀ ਹੈ ਪੰਜਾਬ ਰਾਜ ਵਿੱਚ ਵੱਖ ਵੱਖ ਤਰ੍ਹਾਂ ਦੇ ਸਕੂਲ ਹਨ ਜਿਵੇਂ ਕਿ ਪੰਜਾਬ ਬੋਰਡ ਸੀ ਬੀ ਐੱਸ ਈ ਬੋਰਡ ਅਤੇ ਆਈ ਸੀ ਐੱਸ ਸੀ ਬੋਰਡ ਪੰਜਾਬੀ ਭਾਸ਼ਾ ਪੰਜਾਬ ਬੋਰਡ ਦੇ ਸਾਰੇ ਸਬਜੈਕਟਸ ਪੰਜਾਬੀ ਭਾਸ਼ਾ ਵਿੱਚ ਹਨ ਅਤੇ ਬੱਚਿਆਂ ਨੂੰ ਸਾਰਾ ਜਿਹੜੀ ਹੈ ਸਿੱਖਿਆ ਮਾਤ ਭਾਸ਼ਾ ਪੰਜਾਬੀ ਵਿੱਚ ਦਿੱਤੀ ਜਾਂਦੀ ਹੈ ਪੰਜਾਬ ਬੋਰਡ ਵਿੱਚ ਕੁਛ ਸਕੂਲ ਪੰਜਾਬ ਬੋਰਡ ਦੇ ਹਨ ਜਿਨ੍ਹਾਂ ਵਿੱਚ ਸਾਇੰਸ ਅਤੇ ਮੈਥ ਅੰਗਰੇਜ਼ੀ ਵਿੱਚ ਕਰਵਾਇਆ ਜਾਂਦਾ ਹੈ ਅਤੇ ਬਾਕੀ ਸਾਰੇ ਵਿਸ਼ੇ ਪੰਜਾਬੀ ਭਾਸ਼ਾ ਵਿੱਚ ਪੜ੍ਹਾਏ ਜਾਂਦੇ ਹਨ ਸੋ ਪੰਜਾਬ ਬੋਰਡ ਦੀ ਸਿੱਖਿਆ ਪ੍ਰਣਾਲੀ ਵਿੱਚ ਪੰਜਾਬੀ ਭਾਸ਼ਾ ਬਹੁਤ ਅਹਿਮ ਰੋਲ ਪਰੇਅ ਕਰਦੀ ਹੈ ਸੀ ਬੀ ਐੱਸ ਈ ਬੋਰਡ ਸੀ ਬੀ ਐੱਸ ਈ ਬੋਰਡ ਸੀ ਬੀ ਐੱਸ ਈ ਬੋਰਡ ਵਿੱਚ ਪੰਜਾਬੀ ਭਾਸ਼ਾ ਨੂੰ ਦੂਜੀ ਭਾਸ਼ਾ ਦਾ ਦਰਜਾ ਦਿੱਤਾ ਜਾਂਦਾ ਹੈ ਪਹਿਲੀ ਭਾਸ਼ਾ ਅੰਗਰੇਜ਼ੀ ਲਈ ਜਾਂਦੀ ਹੈ ਅਤੇ ਉਹਦੇ ਵਿੱਚ ਪੰਜਾਬੀ ਭਾਸ਼ਾ ਸਿਰਫ਼ ਇੱਕ ਵਿਸ਼ੇ ਦੇ ਤੌਰ 'ਤੇ ਪੜ੍ਹਾਈ ਜਾਂਦੀ ਹੈ ਬਾਕੀ ਵਿਸ਼ੇ ਅ ਜਿਹੜੇ ਆ ਉਹ ਅੰਗਰੇਜ਼ੀ ਭਾਸ਼ਾ ਵਿੱਚ ਜਾਂ ਹਿੰਦੀ ਵਿੱਚ ਪੜ੍ਹਾਏ ਜਾਂਦੇ ਹਨ ਆਈ ਸੀ ਐੱਸ ਸੀ ਬੋਰਡ ਵਿੱਚ ਵੀ ਪੰਜਾਬੀ ਭਾਸ਼ਾ ਸਿਰਫ਼ ਇੱਕ ਵਿਸ਼ੇ ਦੇ ਤੌਰ 'ਤੇ ਪੜ੍ਹਾਈ ਜਾਂਦੀ ਹੈ